ਪੰਜ ਅਕਤੂਬਰ ਦੋ ਜੀਰੋ ਜੀਰੋ ਜੀਰੋ ਤਿੰਨ ਚਾਰ ਨਵੰਬਰ ਦੋ ਜੀਰੋ ਇੱਕ ਜੀਰੋ ਦੋ ਅੱਠ ਅਪ੍ਰੈਲ ਦੋ ਜੀਰੋ ਜੀਰੋ ਸੱਤ ਅੱਠ ਦਿਸੰਬਰ ਦੋ ਜੀਰੋ ਜੀਰੋ ਨੌਂ ਇੱਕ ਅੱਠ ਮਾਰਚ ਦੋ ਜੀਰੋ ਜੀਰੋ ਤਿੰਨ